ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਜੀ ਅੱਜ ਕੱਲ੍ਹ ਗੁੰਡਾਗਰਦੀ ਬਾਹਲੀ ਵੱਧ ਗਈ ਹੈ ਹਾਂਜੀ ਹਾਂਜੀ ਮੈਂ ਦੇਖਿਆ ਜੀ ਕਈ ਵਾਰ ਇੱਥੇ ਗੁੰਡਾਗਰਦੀ ਚੋਰੀਆਂ ਅਤੇ ਕੋਈ ਆਮ ਜਿਵੇਂ ਅੱਜ ਕੱਲ੍ਹ ਗਰਲਸ ਜਿਵੇਂ ਜਾ ਨੀ ਸਕਦੀਆਂ ਇਹ ਬਹੁਤ ਗੁੰਡਾਗਰਦੀ ਆਪਣੇ ਇੱਥੇ ਵੱਧ ਰਹੀ ਹੈ ਹਾਂਜੀ ਅਤੇ ਇਹਦਾ ਕੀ ਕੀ ਇਲਾਜ ਤੁਸੀਂ ਕੀ ਕਰ ਰਹੇ ਹੋ ਮਤਲਬ ਕੁਝ ਕਰ ਹੀ ਨਹੀਂ ਰਹੇ ਹੋ ਇਸ ਬਾਰੇ ਅੱਛਾ

ਨਹੀਂ ਇਹ ਇਹ ਵੀ ਕੰਮ ਹੈ ਨਾ ਜ਼ਰੂਰੀ ਅੱਜ ਕੱਲ੍ਹ ਦੇਖੀਏ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਜਿਵੇਂ ਗਰਲਸ ਜਾ ਨਹੀਂ ਸਕਦੀਆਂ ਸਕੂਲ ਕਾਲਜ ਹਾਂਜੀ ਇਸ ਕਰਕੇ ਆਪਾਂ ਇਸ ਚੀਜ਼ 'ਤੇ ਵਿਚਾਰ ਹੋਰ ਵੀ ਕਰੀਏ ਅਸੀਂ ਵੀ ਤੁਹਾਡੇ ਨਾਲ ਹਾਂ ਆਪਾਂ ਵੱਧ ਤੋਂ ਵੱਧ ਜਿਹੜਾ ਵੀ ਕਦਮ ਆਪਣਾ ਜਿਵੇਂ ਜੋ ਵੀ ਚੱਕੀਏ ਆਪਾਂ ਇਸ ਦੇ ਵਿਰੁੱਧ ਇਹ ਹਾਂਜੀ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਨਾ ਹੋਏ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਉਹ ਤਾਂ ਕੋਈ ਗੱਲ ਨਹੀਂ ਜੀ ਤੁਹਾਡੇ ਨਾਲ ਹੀ ਹਾਂ ਅਸੀਂ ਵੀ

ਹਾਂਜੀ ਹਾਂਜੀ ਹਾਂ ਨਹੀਂ ਓਹ ਤਾਂ ਉਹ ਤਾਂ ਠੀਕ ਹੈ ਜੀ ਬਾਕੀ ਆਪਾਂ ਇਹ ਮੇਨ ਆਪਣਾ ਤਾਂ ਜ਼ਰੂਰੀ ਕੰਮ ਵੀ ਆਪਾਂ ਜਲਦ ਤੋਂ ਜਲਦ ਇਹਦੇ 'ਤੇ ਵਿਚਾਰ ਕਰੀਏ ਜਾਂ ਇਸ 'ਤੇ ਵੀ ਜੋ ਵੀ ਕਦਮ ਉਠਾਉਣਾ ਆਪਾਂ ਉਠਾਈਏ ਕਿਉਂਕਿ ਦਿਨੋ ਦਿਨ ਕਿਉਂਕਿ ਵੱਧਦੇ ਜਾ ਰਹੇ ਨਾ ਕੰਮ ਉਹ ਤਾਂ ਚਲੋ ਠੀਕ ਹੈ ਬਾਕੀ ਉਹ ਤਾਂ ਜ਼ਰੂਰੀ ਚਲੋ ਆਪਾਂ ਜਿੰਨਾ ਆਪਣੇ ਤੋਂ ਹੋ ਸਕਦਾ ਵਾਧੂ ਆਪਾਂ ਵੀ ਕਰੀਏ ਨਾ ਹਾਂਜੀ ਹਾਂਜੀ ਇਹੀ ਚਲੋ ਆਪਾਂ ਰਲ ਮਿਲ ਕੇ ਜੋ ਵੀ ਕੰਮ ਕਰਨਾ ਕਰੀਏ ਹਾਂ ਇਹ ਤਾਂ ਹੈ ਹਾਂ ਕੋਈ ਨਾ ਕੋਈ ਨਾ ਜੀ ਠੀਕ ਨਹੀਂ ਨਹੀਂ ਆਪਾਂ ਚਲੋ ਆਪਣਾ ਇਹੀ ਹੈ ਮੇਨ ਆਪਾਂ ਕੰਮ ਕਰੀਏ ਜਲਦ ਤੋਂ ਜਲਦ ਠੀਕ ਹੈ ਓਕੇ ਹਾਂਜੀ ਓਕੇ ਓਕੇ ਠੀਕ ਠੀਕ ਹੈ ਠੀਕ ਹੈ ਜੀ ਧੰਨਵਾਦ